ਜ਼ਿਆਦਾਤਰ ਸਮੱਸਿਆਵਾਂ ਦੇ ਹੱਲ ਦੇ ਲਈ ਕਾਨੂੰਨ ਬਣਾਏ ਜਾਂਦੇ ਹਨ ਅਤੇ ਇਹ ਕਾਨੂੰਨਾਂ ਨੂੰ ਜਦੋਂ ਅਸੀਂ ਅਸਲ ਦੇ ਰੂਪ ਦੇ ਵਿੱਚ ਲਾਗੂ ਕਰਦੇ ਹਾਂ ਤਾਂ ਉੱਥੇ ਸਾਡੇ ਕੋਲ ਸਹੀ ਇੱਕ ਸਮੱਸਿਆ ਹੋ ਜਾਂਦੀ ਹੈ ਜਦੋਂ ਸਹੀ ਰੂਪ ਦੇ ਵਿੱਚ ਲਾਗੂ ਨਹੀਂ ਹੁੰਦੇ ਗੇ ਜੇ ਅਸੀਂ ਬਾਲ ਮਜ਼ਦੂਰੀ ਦੀ ਗੱਲ ਕਰਦੇ ਹਾਂ ਤਾਂ ਇੱਥੇ ਜਿਹੜੇ ਕਾਨੂੰਨ ਬੇਸ਼ੱਕ ਬਣੇ ਹੋਏ ਹਨ ਪਰੰਤੂ ਅਸਲ ਦੇ ਵਿੱਚ ਉਹਨਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਜਾਂ ਉਹਨਾਂ ਦੇ ਜਿਹੜੇ ਮਾਂ ਪਿਓ ਉਹ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਨਹੀਂ ਰਹੇ ਗੇ ਤਾਂ ਸਰਕਾਰ ਨੂੰ ਇਹ ਵੀ ਚਾਹੀਦਾ ਕਿ ਉਹ ਇਹ ਕਾਨੂੰਨਾਂ ਨੂੰ ਵੀ ਸਹੀ ਰੂਪ ਦੇ ਵਿੱਚ ਲਾਗੂ ਵੀ ਕਰੇ ਅਤੇ ਨਾਲ ਨਾਲ ਉਹਨਾਂ ਦੇ ਜਿਹੜੇ ਮਾਤਾ ਪਿਤਾ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਾਵੇ ਉਹਨਾਂ ਨੂੰ ਜਾਗਰੂਕ ਵੀ ਕਰੇ ਕਿ ਬੱਚਿਆਂ ਨੂੰ ਮਜ਼ਦੂਰੀ ਹੈ ਜਿਹੜੀ ਨਹੀਂ ਕਰਵਾਉਣੀ ਚਾਹੀਦੀ ਉਹਨਾਂ ਦੀ ਕੁਝ ਕੁ ਮਾਲੀ ਸਹਾਇਤਾ ਵੀ ਕਰਨੀ ਚਾਹੀਦੀ ਹੈ ਬੱਚਿਆਂ ਦੀ ਜਿਸ ਕਾਰਨ ਜਿਹੜੇ ਉਹ ਆਪਣੇ ਬੱਚਿਆਂ ਨੂੰ ਪੜ੍ਹਾ ਕੇ ਇੱਕ ਚੰਗੇ ਨਾਗਰਿਕ ਬਣਾ ਸਕਣ ਅਤੇ ਬੱਚੇ ਵੀ ਪੜ੍ਹ ਕੇ ਆਪਣੇ ਜਿਹੜੇ ਮਾਤਾ ਪਿਤਾ ਦੇ ਜਿਹੜੇ ਉੱਚ ਅਹੁਦਿਆਂ 'ਤੇ ਲੱਗ ਕੇ ਉਹਨਾਂ ਦੀ ਕੁਝ ਸਹਾਇਤਾ ਕਰ ਸਕਣ ਅਤੇ ਉਹਨਾਂ ਦਾ ਨਾਮ ਰੋਸ਼ਨ ਕਰ ਸਕਣ